ਮੈਂ ਪਹਿਲੀ ਵਾਰ ਆਪਣੇ ਗਾਉਣ ਦੀ ਰੁਚੀ ਜਿਵੇਂ ਕਿ ਪਹਿਲੀ ਵਾਰ ਮੈਨੂੰ ਰੇਡੀਓ ਤੋਂ ਪ੍ਰੋਗਰਾਮ ਚੱਲ ਰਿਹਾ ਸੀ ਜਿਹੜਾ ਕਿ ਉਸ ਪ੍ਰੋਗਰਾਮ ਵਿੱਚ ਕੁਝ ਕੁ ਸਿੰਗਰ ਦੇ ਗਾਣੇ ਚੱਲ ਰਹੇ ਸੀਗੇ ਪੰਜਾਬੀ ਉਹਦੇ ਵਿੱਚ ਮੈਨੂੰ ਸੁਣ ਕੇ ਉਹਨਾਂ ਦੀ ਆਵਾਜ਼ ਇੰਨੀ ਵਧੀਆ ਲੱਗੀ ਕਿ ਮੈਂ ਵੀ ਉਹਨਾਂ ਦੀ ਆਵਾਜ਼ ਸੁਣ ਕੇ ਗੁਣ ਗਣਾਉਣ ਲੱਗ ਗਈ ਬਾਅਦ ਵਿੱਚ ਫਿਰ ਮੈਂ ਆਪਣੇ ਸਕੂਲ ਵਿੱਚ ਛੋਟੇ ਹੁੰਦੇ ਪਾਰਟੀਸਪੈਂਟ ਕੀਤਾ ਉਸ ਪ੍ਰੋਗਰਾਮ ਵਿੱਚ ਫਿਰ ਮੈਂ ਵੀ ਹੌਲੀ ਹੌਲੀ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉੱਥੋਂ ਦੇ ਟੀਚਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਫਿਰ ਇਸ ਤਰ੍ਹਾਂ ਮੈਨੂੰ ਆਪਣੇ ਗਾਣਾ ਗਾਉਣ ਦਾ ਮੌਕਾ ਮਿਲਿਆ ਅਤੇ ਇਸ ਤਰ੍ਹਾਂ ਮੈਨੂੰ ਵੀ ਆਪਣੀ ਆਵਾਜ਼ ਅੱਛੀ ਲੱਗੀ ਅਤੇ ਇਸ ਕਰਕੇ ਮੈਂ ਵੀ ਗਾਣਾ ਗਾਉਣ ਵਿੱਚ ਇੰਟਰਸਟ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਮੈਨੂੰ ਆਪਣੀ ਗਾਇਕੀ ਵਿੱਚ ਆਪਣੀ ਪ੍ਰਤਿਭਾ ਖੋਜਣ ਨੂੰ ਮਿਲ ਗਈ ਇਸ ਨਾਲ ਲੋਕਾਂ ਨੂੰ ਵੀ ਮੇਰੀ ਆਵਾਜ਼ ਪ੍ਰਭਾਵਿਤ ਕਰਨ ਲੱਗ ਗਈ ਉਹਨਾਂ ਦੁਆਰਾ ਵੀ ਕੁਛ ਕੁ ਸਹਿਯੋਗ ਮੇਰੀ ਗਾਇਕੀ ਨੂੰ ਪ੍ਰਭਾਵਿਤ ਕੀਤਾ ਅਤੇ ਉਹਨਾਂ ਨੇ ਮੈਨੂੰ ਉਤਸ਼ਾਹਿਤ ਤੌਰ 'ਤੇ ਗਾਇਕੀ ਦਾ ਸਨਮਾਨ ਕੀਤਾ